ਟੈਕਨੋਲੋਜੀ ਦੀ ਵਰਤੋਂ ਕਰਦੇ ਸਮੇਂ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਹਨ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਚੁਣੌਤੀਆਂ ਤੋਂ ਉਹਨਾਂ ਨੂੰ ਨਿਕਲਣ ਵਾਸਤੇ ਸਾਨੂੰ ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਇਹਨਾਂ ਚੁਣੌਤੀਆਂ ਤੋਂ ਕਿੱਦਾਂ ਨਿਕਲਿਆ ਜਾ ਸਕਦਾ ਉਹਨਾਂ ਨੂੰ ਮੋਬਾਈਲ ਫੋਨ ਚਲਾਉਣ ਦੀ ਚਲਾਉਣ ਦੀ ਸਲਾਹ ਦੇਣੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਮੋਬਾਈਲ ਫੋਨ ਤੋਂ ਅਸੀਂ ਕਿੱਦਾਂ ਕਿਸੇ ਨੂੰ ਪੈਸੇ ਭੇਜ ਸਕਦੇ ਹਾਂ ਕਿੱਦਾਂ ਕਿੱਦਾ ਅਸੀਂ ਬਿਜਲੀ ਦਾ ਬਿੱਲ ਉਤਾਰ ਸਕਦੇ ਹਾਂ ਕਿਸ ਕਿੱਦਾਂ ਅਸੀਂ ਕਿਸੇ ਨੂੰ ਕੋਈ ਮੈਸੇਜ ਭੇਜ ਸਕਦੇ ਹਾਂ ਅਤੇ ਅਸੀਂ ਬੋਲ ਕੇ ਵੀ ਮੋਬਾਈਲ ਤੋਂ ਦੂਜੇ ਬੰਦੇ ਨੂੰ ਮੈਸੇਜ ਭੇਜ ਸਕਦੇ ਹਾਂ ਅਤੇ ਬਜ਼ੁਰਗਾਂ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਫੋਨ ਦੀ ਵਰਤੋਂ ਕਿੱਦਾਂ ਕਰਨੀ ਹੈ ਜਾਂ ਟੈਕਨੋਲੋਜੀ ਦੀ ਵਰਤੋਂ ਕਿੱਦਾਂ ਕਰਨੀ ਹੈ ਤਾਂ ਕਿ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਬਜ਼ੁਰਗਾਂ ਨੂੰ ਕਈ ਵਾਰ ਘਰ ਬੈਠੇ ਕੋਈ ਨਹੀਂ ਹੁੰਦਾ ਹੈ ਅਤੇ ਉਹ ਪਰੇਸ਼ਾਨ ਹੋ ਜਾਂਦੇ ਹਨ ਕਿਸੀ ਵੀ ਚੀਜ਼ ਨੂੰ ਲੈ ਕੇ ਜਿਵੇਂ ਘਰ ਕੋਈ ਸਿਲੰਡਰ ਆਇਆ ਹੈ ਜਾਂ ਘਰ ਕੋਈ ਬਿੱਲ ਆ ਗਿਆ ਹੈ ਜਾਂ ਉਹਦੇ ਬਾਰੇ ਕੋਈ ਉਹਨਾਂ ਨੇ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਉਹਨਾਂ ਨੂੰ ਟੈਕਨੋਲੋਜੀ ਦਾ ਵਰਤੋਂ ਕਰਨੀ ਦੱਸਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਉਹਨਾਂ ਨੂੰ ਸਿਖਾਵਾਂਗੇ ਜਦੋਂ ਤੱਕ ਅਸੀਂ ਉਹਨਾਂ ਨੂੰ ਨਹੀਂ ਸਿਖਾਵਾਂਗੇ ਤਾਂ ਉਹ ਕਿੱਥੋਂ ਸਿੱਖਣਗੇ ਬਲਕਿ ਬਜ਼ੁਰਗ ਤਾਂ ਸਾਡੇ ਤੋਂ ਜ਼ਿਆਦਾ ਅ ਹੰਢੇ ਹੁੰਦੇ ਹਨ ਅਤੇ ਉਹ ਬਹੁਤ ਜਲਦੀ ਹਰ ਗੱਲ ਨੂੰ ਸਿੱਖਦੇ ਹਨ ਜੇਕਰ ਕੋਈ ਨਹੀਂ ਪੜ੍ਹਨਾ ਨਹੀਂ ਵੀ ਜਾਣਦਾ ਬਜ਼ੁਰਗ ਤਾਂ ਉਹ ਬੋਲ ਕੇ ਆਪਣੀ ਗੱਲ ਰੱਖ ਸਕਦੇ ਹਨ ਬੋਲ ਕੇ ਆਪਣੀ ਗੱਲ ਰੱਖ ਕੇ ਉਹ ਆਪਣੀ ਗੱਲ ਦਾ ਜਵਾਬ ਲੈ ਸਕਦੇ ਹਨ